ਭੰਗੜਾ ਪੰਜਾਬੀ ਸੱਭਿਆਚਾਰ ਦਾ ਇੱਕ ਅਟੂਟ ਅੰਗ ਹੈ ਭੰਗੜਾ ਖੁਸ਼ੀ ਦੇ ਪ੍ਰਗਟਾਵੇ ਦੀ ਨਿਸ਼ਾਨੀ ਹੈ ਪੰਜਾਬੀ ਜਨਮ ਤੋਂ ਲੈ ਕੇ ਵਿਵਾਹ ਤੱਕ ਭੰਗੜਾ ਕਰਕੇ ਹੀ ਆਪਣੀ ਖੁਸ਼ੀ ਪ੍ਰਗਟ ਕਰਦੇ ਹਨ ਕਿਸਾਨ ਆਪਣੀ ਫਸਲ ਬੀਜਣ ਤੋਂ ਲੈ ਕੇ ਕੱਟਣ ਤੱਕ ਆਪਣੀ ਖੁਸ਼ੀ ਭੰਗੜਾ ਕਰਕੇ ਹੀ ਕਰਦੇ ਹਨ ਅੱਜ ਕੱਲ੍ਹ ਕਈ ਲੋਕ ਤਾਂ ਕਸਰਤ ਵਜੋਂ ਵੀ ਭੰਗੜਾ ਪਾਂਦੇ ਹਨ ਤਾਂ ਕੀ ਉਨ੍ਹਾਂ ਦਾ ਸ਼ਰੀਰ ਚੁਸਤ ਫੁਰਤ ਅਤੇ ਤੰਦਰੁਸਤ ਰਵੇ ਪੰਜਾਬ ਅਤੇ ਪੰਜਾਬੀਅਤ ਨੂੰ ਅੱਗੇ ਲੈ ਕੇ ਜਾਣ ਲਈ ਭੰਗੜੇ ਦਾ ਇੱਕ ਅਹਿਮ ਰੋਲ ਹੈ ਭੰਗੜਾ ਹੀ ਸਾਡੇ ਪੰਜਾਬ ਨੂੰ ਬਾਕੀ ਦੇਸ਼ਾਂ ਚ ਮਸ਼ਹੂਰ ਕਰਵਾਂਦਾ ਹੈ ਅਤੇ ਇਸ ਨਾਲ ਸਾਡੇ ਪੰਜਾਬ ਦੀ ਪਹਿਚਾਣ ਵੀ ਹੁੰਦੀ ਹੈ ਅਤੇ ਹਰ ਕਿਹੇ ਸਕੂਲ ਕੋਲਜ ਵਿੱਚ ਵੀ ਬੱਚਿਆਂ ਨੂੰ ਭੰਗੜੇ ਬਾਰੇ ਦੱਸਿਆ ਜਾਂਦਾ ਹੈ ਕੀ ਕਿਵੇਂ ਭੰਗੜਾ ਕਰਕੇ ਕਈ ਬੱਚੇ ਕਈ ਇਨਾਮ ਵੀ ਜਿੱਤਦੇ ਹਨ